ਮੇਰਾ ਸਭ ਤੋਂ ਉੱਚਾ ਰਿਕਾਰਡ ਮੇਰੇ ਬਚਪਨ ਦਾ ਹੈ ਜਿਸਦੇ ਵਿੱਚ ਮੈਂ ਪਲਸ ਟੂ ਪ੍ਰੀਖਿਆ ਵਿੱਚੋਂ ਸਕੂਲ ਦੇ ਵਿੱਚੋਂ ਪਹਿਲੇ ਨੰਬਰ 'ਤੇ ਆਇਆ ਸੀਗਾ ਇਸਦੇ ਨਾਲ ਨਾਲ ਵਾਲੀਵਾਲ ਖੇਡ ਵਿੱਚ ਮੈਂ ਪੰਜਾਬ ਟੋਪਰ ਸੀਗਾ ਅਤੇ ਇਹ ਮੇਰੀਆਂ ਉੱਚੀਆਂ ਪ੍ਰਾਪਤੀਆਂ ਸੀਗੀਆਂ ਮੈਂ ਹਰ ਰੋਜ਼ ਸੈਰ ਕਰਨ ਜਾਂਦਾ ਹਾਂ ਅਤੇ ਸੈਰ ਕਰਨ ਦੇ ਲਈ ਘੱਟੋ ਘੱਟ ਇਕ ਘੰਟਾ ਮੈਂ ਜ਼ਰੂਰ ਲਗਾਉਂਦਾ ਹਾਂ ਮੇਰਾ ਟੀਚਾ ਇਹ ਸੀਗਾ ਕਿ ਮੈਂ ਆਪਣਾ ਵੇਟ ਘਟਾਵਾਂ ਅਤੇ ਸ਼ੂਗਰ ਆਦਿ ਹੋਰ ਜੋ ਬਿਮਾਰੀਆਂ ਹਨ ਉਹਨਾਂ ਨੂੰ ਮੈਂ ਦੂਰ ਕਰਾਂ ਹੁਣ ਮੈਂ ਉਹ ਟੀਚਾ ਪ੍ਰਾਪਤ ਕਰ ਲਿਆ ਹੈ ਅਤੇ ਮੈਨੂੰ ਬੜੀ ਖੁਸ਼ੀ ਹੈ